ਸੋਲ੍ਹਾਂ ਅਗਸਤ ਉੱਨੀ ਸੌ ਬਾਨਵੇਂ ਪੰਦਰਾਂ ਦਸੰਬਰ ਉੱਨੀ ਸੌ ਛਿਆਨਵੇਂ ਸਤਾਰਾਂ ਸਤੰਬਰ ਉੱਨੀ ਸੌ ਛਿਆਸੀ ਦੋ ਜਨਵਰੀ ਉੱਨੀ ਸੌ ਇਕਾਨਵੇਂ ਸੱਤ ਜੁਲਾਈ ਦੋ ਹਜ਼ਾਰ ਬਾਈ